ਪਿਛਲੇ ਹਫ਼ਤੇ ਮੈਂ ਔਨਲਾਈਨ ਇੱਕ ਜੈਕਟ ਮੰਗਵਾਈ ਸੀ ਜੈਕਟ ਦਾ ਬ੍ਰੈਂਡ ਟੋਮੀ ਸੀ ਜੈਕਟ ਬੜੀ ਵਧੀਆ ਸਰਦੀ ਦੇ ਵਿੱਚ ਪਾਉਣ ਦੇ ਲਈ ਨਿੱਘੀ ਹੈ ਅਤੇ ਉਹਦਾ ਕੱਪੜਾ ਬਹੁਤ ਵਧੀਆ ਬਿਲਕੁਲ ਵੀ ਤੰਗੀ ਜਿਹੜੀ ਉਹ ਉਹਨੂੰ ਪਾ ਕੇ ਨਹੀਂ ਆਉਂਦੀ